ਕੱਪੜੇ ਦੇ ਕੱਪੜੇ ਮੈਂ ਹੁਣ ਮਸ਼ੀਨ ਨਾਲ ਧੋਂਦੀ ਹਾਂ ਇਹ ਤੋਂ ਪਹਿਲਾਂ ਦਸ ਸਾਲ ਪਹਿਲਾਂ ਅਸੀਂ ਹੱਥਾਂ ਨਾਲ ਧੋਂਦੇ ਸੀ ਅਤੇ ਹੁਣ ਅੱਜ ਦੇ ਜ਼ਮਾਨੇ ਦੇ ਨਾਲ ਚੱਲ ਕੇ ਅਸੀਂ ਮਸ਼ੀਨ ਨਾਲ ਕੱਪੜੇ ਧੋਂਦੇ ਹਾਂ ਅਤੇ ਸੁਕਾਉਂਦੇ ਵੀ ਹਾਂ ਕਈ ਵਾਰੀ ਤਾਂ ਖਾਸ ਹੱਥਾਂ ਨਾਲ ਉਹ ਕੱਪੜੇ ਧੋਂਦੇ ਹਾਂ ਜਿਹੜੇ ਸਾਡੇ ਸਿੱਪੀਆਂ ਸਿਤਾਰਿਆਂ ਵਾਲੇ ਹੁੰਦੇ ਹਨ ਉਹਨਾਂ ਨੂੰ ਹੱਥਾਂ ਨਾਲ ਧੋ ਕੇ ਸੁਕਾਉਂਦੇ ਹਾਂ ਕਈ ਵਾਰੀ ਬਾਰਿਸ਼ ਲੱਗ ਜਾਂਦੀ ਹੈ ਤਾਂ ਅਸੀਂ ਉਹਨੂੰ ਸੁਕਾਉਣ ਲਈ ਬੜੀ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕਦੀ ਅੰਦਰ ਅਤੇ ਕਦੀ ਬਾਹਰ ਸੁੱਕਣੇ ਪਾਉਂਦੇ ਹਾਂ ਅਤੇ ਉਹਨਾਂ ਨੂੰ ਕਈ ਵਾਰੀ ਪਰੈ ਕਈ ਵਾਰੀ ਕਿਤੇ ਜਾਣਾ ਹੋਵੇ ਤਾਂ ਗਿੱਲਾ ਕੱਪੜਾ ਹੋਵੇ ਜ਼ਰੂਰਤ ਹੋਵੇ ਤਾਂ ਸ ਡਰਾਈ ਕੀਤਾ ਸੁਕਾਇਆ ਹੋਏ ਮਸ਼ੀਨ ਦੇ ਵਿੱਚ ਤਾਂ ਅਸੀਂ ਉਹਨੂੰ ਪ੍ਰੈਸ ਕਰਕੇ ਵੀ ਪਾ ਲੈਂਦੇ ਹਾਂ ਨਹੀਂ ਤਾਂ ਅਸੀਂ ਅਸੀਂ ਸ਼ੈਂਪੂ ਨਾਲ ਵੀ ਨਵੇਂ ਕੱਪੜਿਆਂ ਨੂੰ ਧੋ ਕੇ ਰੱਖ ਕੇ ਅਤੇ ਮਸ਼ੀਨ 'ਚ ਸੁਕਾ ਕੇ ਕਈ ਵਾਰੀ ਅਸੀਂ ਉਹਦੇ 'ਤੇ ਨਾਲ ਪ੍ਰੈਸ ਨਾਲ ਵੀ ਸੁਕਾਉਂਦੇ ਹਾਂ ਅਤੇ ਉਸ ਨੂੰ ਦੁਬਾਰਾ ਸੁੱਕਣੇ ਪਾ ਕੇ ਹਵਾ ਲਵਾ ਲੈਂਦੇ ਹਾਂ ਕਈ ਵਾਰੀ ਪੱਖੇ ਥੱਲੇ ਵੀ ਪਾ ਕੇ ਸੁਕਾ ਲੈਂਦੇ ਹਾਂ ਕੱਪੜਿਆਂ ਨੂੰ ਕਮਰਿਆਂ ਦੇ ਵਿੱਚ ਫੈਲਾ ਕੇ ਸੁਕਾ ਪੱਖਾ ਉੱਤੋਂ ਪੱਖਾ ਚਲਾ ਦਿੰਦੇ ਹਾਂ ਤੇ ਕੱਪੜੇ ਸੁੱਕ ਜਾਣ ਅਤੇ ਪਾਉਣ ਜੋਗੇ ਹੋ ਜਾਣ ਛੋਟੀ ਛੋਟੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਬੜੀਆਂ ਤਕਨੀਕਾਂ ਦੇ ਨਾਲ ਕੱਪੜਿਆਂ ਨੂੰ ਸੁਕਾ ਲੈਂਦੇ ਹਾਂ ਕਈ ਵਾਰੀ ਰੁਮਾਲਸ ਹੋਣ ਧੋਤੇ ਹੋਣ ਤਾਂ ਨਹੀਂ ਸੁੱਕਦੇ ਅਤੇ ਸੁ